ਹਾਂਜੀ ਹਾਂਜੀ ਹਾਂਜੀ ਮੈਮ ਹਾਂਜੀ ਮੈਮ ਆਪ ਕੋ ਆਪਨੇ ਹਮੇਂ ਓਡਰ ਦੇਨਾ ਥਾ ਸੁਬਹ ਸ਼ਾਮ ਕਾ ਬਤਾਇਆ ਬਤਾ ਦੀਜੀਏ ਕੈਸੇ ਕਰਨਾ ਹੈ ਹਾਂਜੀ ਅੱਛਾ ਜੀ ਅੱਛਾ ਸ਼ੇਕ ਮੈਮ ਕਿਹੜਾ ਬਣਾਉਣਾ ਅਸੀਂ ਹਾਂ ਦੱਸ ਦਿਓ ਬਨਾਨਾ ਸ਼ੇਕ ਪੁੱਛ ਰਹੀ ਠੀਕ ਆ ਜੀ ਠੀਕ ਹੈ ਲੰਚ ਠੀਕ

ਚਾਵਲ ਮੈਮ ਦਾਲ ਫਰਾਈ ਵਾਲੇ ਬਣਾਉਣੇ ਹੈ ਜਾਂ ਆਪਾਂ ਸਿੰਪਲ ਵਾਲੇ ਬਣਾਈਏ ਬੋਇਲ ਕਰਕੇ ਠੀਕ ਹੈ ਜੀ ਰਾਈਸ ਜੀਰਾ ਰਾਈਸ ਬਣਾ ਲਾਂਗੇ ਮਟਰ ਪਾ ਕੇ ਠੀਕ ਹੈ ਠੀਕ ਹੈ ਜੀ ਠੀਕ ਹੈ ਓਕੇ ਮੈਮ ਠੀਕ ਹੈ ਮੈਮ ਅੱਛਾ ਠੀਕ ਹੈ ਜੀ ਅ ਮੈਮ ਕਿੰਨੇ ਕੁ ਜਣਿਆਂ ਵਾਸਤੇ ਬਣਾਉਣਾ ਅਸੀਂ ਠੀਕ ਹੈ ਮੈਮ ਅੱਛਾ ਜੀ ਹਾਂਜੀ ਠੀਕ ਹੈ

ਠੀਕ ਹੈ ਮੈਮ ਠੀਕ ਹੈ ਮੈਮ ਓਕੇ ਮੈਮ ਹੂੰ ਕਿੰਨੇ ਕੁ ਵਜੇ ਤੱਕ ਮਤਲਬ ਕਰ ਦੇਈਏ ਅਸੀਂ ਰੈਡੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਮੈਮ ਪਰ ਮੈਮ ਮੈਨੂੰ ਇੱਕ ਹੈਲਪਰ ਅ ਮਿਲ ਸਕਦਾ ਠੀਕ ਹੈ ਮੈਮ ਠੀਕ ਹੈ ਮੈਮ ਓਕੇ ਥੈਂਕਿਉ